ਪੰਜਾਬ ਭਾਰਤ ਦਾ ਇੱਕ ਬਹੁਤ ਹੀ ਸ਼ਾਨਦਾਰ ਰਾਜ ਹੈ ਇਸ ਦੇ ਨਾਲ ਪਾਕਿਸਤਾਨ ਦੀ ਹੱਦ ਬਹੁਤ ਜ਼ਿਆਦਾ ਲੱਗਦੀ ਹੈ ਜਿਹਨੂੰ ਮੈਂ ਅੰਮ੍ਰਿਤਸਰ ਰਹਿੰਦਾ ਹਾਂ ਅਤੇ ਮੇਰੇ ਵਾਲੇ ਪਾਸਿਓਂ ਜੋ ਲੱਗਦਾ ਹੈ ਉਹ ਹੈ ਵਾਹਗਾ ਬੋਡਰ ਇਤਿਹਾਸਿਕ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਕੰਜਰੀ ਪੁੱਲ ਹੈ ਜੋ ਵਾਹਗਾ ਬਾਡਰ ਤੋਂ ਥੋੜ੍ਹੀ ਜਿਹੀ ਪਹਿਲਾਂ ਸੱਜੇ ਪਾਸੇ ਅੰਦਰ ਮੁੜ ਕੇ ਪਿੰਡਾਂ ਦੇ ਵਿੱਚੋਂ ਜਾ ਕੇ ਪਹੁੰਚੀਦਾ ਹੈ ਅਟਾਰੀ ਥਾਂ ਹੈ ਅਟਾਰੀ ਜੋ ਹੈ ਉਹ ਪਿੰਡ ਪੰਜਾਬ ਦਾ ਅੰਮ੍ਰਿਤਸਰ ਦਾ ਹੈ ਉੱਥੇ ਸ਼ਾਮ ਸਿੰਘ ਅਟਾਰੀ ਦੀ ਇੱਕ ਬਹੁਤ ਹੀ ਸੋਹਣੀ ਯਾਦਗਾਰ ਬਣੀ ਹੋਈ ਹੈ ਉਹਨਾਂ ਦਾ ਕਿਲ੍ਹਾ ਵੀ ਅੰਦਰ ਹੈਗਾ ਉਹਦੀ ਕੋਈ ਵੀ ਇਸ ਟਾਈਮ ਦੇਖਭਾਲ ਨਹੀਂ ਕਰਦਾ ਉਹਦੇ ਆਲ਼ੇ ਦੁਆਲ਼ੇ ਛੋਟਾ ਜਿਹਾ ਪਿੰਡ ਵਸਿਆ ਹੈ ਉੱਥੋਂ ਦੀ ਜਿਹੜੀ ਰੋਜ਼ੀ ਰੋਟੀ ਚੱਲਦੀ ਹੈ ਉਹ ਵਾਹਗਾ ਬੋਡਰ ਤੋਂ ਚੱਲਦੀ ਹੈ ਪੰਜਾਬ ਦੀਆਂ ਇਤਿਹਾਸਿਕ ਹੋਰ ਬਹੁਤ ਸਾਰੀਆਂ ਥਾਵਾਂ ਨੇ ਪੰਜਾਬ ਜਿਹੜਾ ਹੈ ਉਹ ਗੁਰੂਆਂ ਪੀਰਾਂ ਦੀ ਧਰਤੀ ਰਹੀ ਹੈ ਇੱਥੇ ਬਹੁਤ ਸਾਰੇ ਗੁਰੂਆਂ ਦੇ ਪੀਰਾਂ ਨੇ ਆਪਣੇ ਪੈਰ ਪਾਏ ਨੇ ਉਹਨਾਂ ਦੀਆਂ ਥਾਵਾਂ ਦੇ ਉੱਤੇ ਕੋਈ ਨਾ ਕੋਈ ਗੁਰਦੁਆਰਾ ਕੁਛ ਬਣਿਆ ਹੋਇਆ ਹੈ ਜਿੱਥੇ ਲੋਕ ਜਾਂਦੇ ਨੇ ਮੱਥਾ ਟੇਕਦੇ ਹਨ